ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਲਜੀਤ ਸਿੰਘ ਹੈ ਮੈਂ ਤੁਹਾਡੀ ਵੈੱਬਸਾਈਟ ਤੋਂ ਕੁਝ ਡੱਬੇ ਪਲਾਸਟਿਕ ਦੇ ਡੱਬੇ ਮੰਗਵਾਏ ਸੀ ਉਹ ਮੈਂ ਉਹਨਾਂ ਦਾ ਰੰਗ ਕਾਲ਼ਾ ਮੰਗਵਾਇਆ ਸੀ ਅਤੇ ਉਹ ਪੀਲ਼ੇ ਆਏ ਹਨ ਉਹਨਾਂ ਉਹਨਾਂ ਦੀ ਕੁਆਲਿਟੀ ਬਿਲਕੁਲ ਸਹੀ ਚੰਗੀ ਨਹੀਂ ਹੈ ਉਹਨਾਂ ਉਹ ਜਮ੍ਹਾਂ ਹੀ ਬੇਕਾਰ ਹਨ ਅਤੇ ਉਹਨਾਂ ਵਿੱਚ ਕੋਈ ਚੀਜ਼ ਪਾ ਵੀ ਨਹੀਂ ਸਕਦੇ ਉਹ ਮੁਸ ਵੀ ਔਰ ਛੇਤੀ ਹੀ ਜਾਂਦੇ ਹਨ ਉਹਨਾਂ ਦੀ ਕੁਆਲਿਟੀ ਬਿਲਕੁਲ ਠੀਕ ਨਹੀਂ ਹੈ ਇਸ ਕਰਕੇ ਮੈਂ ਇਹ ਡੱਬੇ ਨਹੀਂ ਰੱਖਣਾ ਚਾਹੁੰਦਾ ਮੇਰੇ ਘਰਦੇ ਕਹਿੰਦੇ ਹਨ ਵੀ ਇਹ ਡੱਬੇ ਵਾਪਸ ਕੀਤੇ ਜਾਣ ਅਤੇ ਮੈਂ ਇਹ ਡੱਬੇ ਨਹੀਂ ਰੱਖ ਸਕਦਾ ਕਿਰਪਾ ਕਰਕੇ ਜਾਂ ਤਾਂ ਮੈਨੂੰ ਪੈਸੇ ਦਿੱਤੇ ਜਾਣ ਜਾਂ ਫਿਰ ਮੈਨੂੰ ਇਹ ਡੱਬੇ ਮੋੜ ਜਾਂ ਮੋੜ ਦਿੱਤੇ ਜਾਣ ਇਸ ਕਰਕੇ ਮੈਂ ਇਹ ਇਹੀ ਮੰਗ ਕਰਦਾ ਹਾਂ ਕਿ ਜਾਂ ਤਾਂ ਮੈਨੂੰ ਪੈਸੇ ਮੋੜ ਦਿੱਤੇ ਜਾਣ ਧੰਨਵਾਦ